ਪੰਜਾਬ ਵਿੱਚ ਬਹੁਤ ਸਾਰੀਆਂ ਸਪੋਰਟਸ ਟੀਮਾਂ ਹਨ ਜਿਸ ਦੇ ਵਿੱਚ ਹਾਕੀ ਕ੍ਰਿਕਟ ਬੈਡਮਿੰਟਨ ਟੈਨਿਸ ਫੁੱਟਬਾਲ ਔਰ ਵਾਲੀਬਾਲ ਵਗੈਰਾ ਕਬੱਡੀ ਵੀ ਅ ਇੱਥੋਂ ਦੀ ਇੱਕ ਪ੍ਰਮੁੱਖ ਟੀਮ ਆ